ਹੈਲੋ ਹਾਂ ਇਸ਼ਾਂਨ ਕਿੱਦਾਂ ਮੈਂ ਵੀ ਠੀਕ ਯਾਰ ਰਿਜਲਟ ਤਾਂ ਆਇਆ ਨਹੀਂ ਯਾਰ ਹਜੇ ਆਉਣਾ ਕਿੱਦਾਂ ਦੇ ਗਏ ਪੇਪਰ ਤੇਰੇ ਮੇਰੇ ਵੀ ਠੀਕ ਹੀ ਗਏ ਹਾਂ ਯਾਰ ਦੇਖੋ ਹੁਣ ਕਿਆ ਹੁੰਦਾ ਕਿਆ ਨਹੀਂ ਸੋਚ ਰਿਹਾ ਯਾਰ ਕਿ ਦੇਖੋ ਹੁਣ ਮਤਲਬ ਕਿ ਪਠਾਨਕੋਟ ਡਿਸਟਿਕ ਏ ਮਿਲ ਜਾਵੇ ਵਧੀਆ ਕਾਲਜ ਪਲੇਸਮੈਂਟ ਵਧੀਆ ਹੋਏ ਹਾਂ ਯਾਰ ਇੰਜਨੀਅਰਿੰਗ ਕਰਾਂਗਾ ਮੈਂ ਵੀ ਮੇਰੇ ਭਰਾ ਨੇ ਕੀ ਕਰੂਗਾ

ਹਾਂ ਮੈਂ ਵੀ ਸੁਣਿਆ ਕਿ ਪਲੇਸਮੈਂਟ ਵੀ ਠੀਕ ਹੈ ਹਾਂ ਵਧੀਆ ਵਧੀਆ ਹਾਂ ਮੇਨ ਤਾਂ ਸਕਿੱਲ ਹੀ ਹੁੰਦੀ ਆ ਵੈਸੇ ਕੀਤੀ ਉੱਥੇ ਰਜਿਸਟਰੇਸ਼ਨ ਕਰਵਾਈ ਜਾ ਹਜੇ ਜਾਂ ਨਹੀਂ ਹਾਂ ਤਾਂ ਹੀ ਮੈਂ ਫਿਰ ਕਾਲ ਕਰ ਲੈਣਾ ਮੈਂ ਕਿਹਾ ਯਾਰ ਰਿਜ਼ਲਟ ਤਾਂ ਆ ਹੀ ਜਾਣੇ ਆ ਹੁਣ ਪਾਸ ਤਾਂ ਹੋ ਹੀ ਜਾਣਾ ਮੈਂ ਕਿਹਾ ਅੱਗੇ ਫਿਰ ਦੇਖੀਏ ਫਿਊਚਰ ਸਿਕਿਓਰ ਕਰੀਏ ਆਪਣਾ ਕੋਈ ਨਹੀਂ ਜਦੋਂ ਜਾਏਗਾ ਮੇਰਾ ਵੀਰ ਤੂੰ ਤਾਂ ਦੱਸੀ ਮੈਨੂੰ ਕਦੋਂ ਜਾਣਾ ਕਦੋਂ ਨਹੀਂ ਤਾਂ ਇਕੱਠੇ ਚੱਲ ਪਾਂਗੇ ਆਪਾਂ ਹੈ ਨਾ ਵੀ ਚਲ ਫਿਰ ਠੀਕ ਮੇਨ ਯਾਰ ਮੇਨ ਤਾਂ ਪੈਕਜ ਚਾਹੀਦਾ ਆਪਾਂ ਨੂੰ ਕਿ ਪਲੇਸਮੈਂਟ ਹੋ ਜਾਵੇ ਸਹੀ ਅਤੇ ਵੈਸੇ ਇੰਜੀਨੀਅਰਿੰਗ ਕਿਸ 'ਚ ਸੋਚੀ ਕੰਪਿਊਟਰ ਸਾਇੰਸ 'ਚ ਹਾਂ ਸਕੋਪ ਵੀ ਉਹੀ ਯਾਰ ਅੱਗੇ ਜਿੱਦਾਂ ਤੈਨੂੰ ਪਤਾ ਏ ਆਈ ਕਿੰਨਾ ਫੈਲ ਰਿਹਾ ਹੁਣ ਹਾਂ ਬੰਦਾ ਡਾਟਾ ਐਨਾਲਿਸਟ ਬਣ ਜਾਂਦਾ ਕੋਈ ਪਹਿਲੇ ਮੈਂ ਸੋਚ ਰਿਹਾ ਕਿ ਐਥੀਕਲ ਹੈਕਿੰਗ ਕਰਾ ਪਰ ਮੈਂ ਕਿਹਾ ਕਿਆ ਕਰੂੰਗਾ ਉਹ ਕਰਕੇ ਹਾਰ ਕੇ ਚਲ ਕੋਈ ਨਹੀਂ

ਏ ਐਨ ਐਮ ਹੈ 'ਚ ਸ਼ਾਇਦ ਮੈਂ ਵੇ ਏ ਬੀ ਕੋਲੇਜ ਪਤਾ ਕੀਤਾ ਸੀ ਉੱਥੇ ਨਹੀਂ ਆ ਏ ਬੀ ਕੋਲੇਜ ਹੈ ਨਹੀਂ ਆ ਬਾਕੀ ਐਸ ਪੀ ਦਾ ਤੈਨੂੰ ਐਸ ਡੀ ਦਾ ਹਾਲ ਤਾਂ ਪਤਾ ਹੀ ਹੈ ਕਿੱਦਾਂ ਕਿੱਦਾਂ ਨਹੀਂ ਚਲ ਕੋਈ ਨਾ ਦੇਖਦੇ ਹਾਂ ਮੇਰਾ ਵੀਰ ਠੀਕ ਹੈ ਜਦੋਂ ਜਾਏਗਾ ਤਾਂ ਫਿਰ ਮਾਰ ਦੀ ਕੋਲ ਮੈਨੂੰ ਇਕੱਠੇ ਚਲ ਪਾਂਗੇ ਰਜਿਸਟ੍ਰੇਸ਼ਨ ਕਰਾ ਆਵਾਂਗੇ ਆਪਾਂ ਚਲੋ ਕੋਈ ਨਾ ਕਰ ਤੂੰ ਮੇਰਾ ਵੀਰ ਇੰਸਪੈਕਲੇਟ ਠੀਕ ਹੈ ਓਕੇ ਚੰਗਾ ਮੇਰਾ ਵੀਰ ਓਕੇ ਬਾਏ